ਮੇਰਾ ਸਭ ਤੋਂ ਪਿਆਰਾ ਨੇਤਾ ਰਜੀਵ ਗਾਂਧੀ ਹੈ ਇਹ ਭਾਰਤ 'ਚ ਪਹਿਲੀ ਵਾਰ ਕੰਪਊਟਰ ਲੈ ਕੇ ਆਏ ਸੀ ਇਹਨਾਂ ਨੂੰ ਕੰਪਊਟਰ ਦਾ ਬੋਆਏ ਵੀ ਕਿਹਾ ਜਾਂਦਾ ਹੈ ਸਿੱਖਿਆ ਪੱਧਰ ਬਹੁਤ ਉੱਚਾ ਕੀਤਾ ਹੈ ਇਸਦੇ ਨਾਲ ਹੀ ਮਨੋਰੰਜਨ ਆਵਾਜਾਈ ਅਤੇ ਵਿਗਿਆਨ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਪ੍ਰਭਾਵਿਤ ਕੀਤਾ ਹੈ ਆਉਣ ਵਾਲੀ ਜ਼ਿੰਦਗੀ ਵਿੱਚ ਇਸ ਦੇ ਬਹੁਤ ਫਾਇਦੇ ਮਿਲਣਗੇ